ਹੈਲੋ ਸਤਿ ਸ਼੍ਰੀ ਅਕਾਲ ਅੰਕਲ ਜੀ ਅੰਕਲ ਜੀ ਅਸੀਂ ਦਿੱਲੀਓਂ ਬੋਲ ਰਹੇ ਹਾਂ ਅਤੇ ਅਸੀਂ ਮਤਲਬ ਗੁਰਦੁਆਰੇ ਆ ਕੇ ਸੇਵਾ ਕਰਨੀ ਸੀ ਅਤੇ ਕਿਹੜੀ ਕਿਹੜੀ ਸੇਵਾ ਕਰ ਸਕਦੇ ਅਤੇ ਕਿੰਨੇ ਮੈਂਬਰ ਆ ਸਕਦੇ ਹਾਂ ਠੀਕ ਹੈ ਅੰਕਲ ਜੀ ਅਸੀਂ ਤੁਹਾਨੂੰ ਜਲਦੀ ਹੀ ਫ਼ੋਨ ਕਰਾਂਗੇ ਫਿਰ ਠੀਕ ਹੈ ਓਕੇ ਜੀ ਸਤਿ ਸ਼੍ਰੀ ਅਕਾਲ